ਮੈਂ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਖਿੱਚੀ ਸੀ ਉਹ ਮੈਂ ਵੀਹ ਸਾਲ ਦੀ ਉਮਰ ਦੇ ਵਿੱਚ ਖਿੱਚੀ ਸੀ ਉਸ ਟਾਈਮ ਮੈਂ ਬੀ ਏ ਦੇ ਵਿੱਚ ਸਟੱਡੀ ਕਰਦੀ ਸੀ ਅਤੇ ਸਾਡਾ ਬੀ ਏ ਦੇ ਵਿੱਚ ਸਾਰੇ ਵਿਦਿਆਰਥੀਆਂ ਦਾ ਜਿਹੜਾ ਟੂਰ ਸ਼ਿਮਲੇ ਗਿਆ ਸੀ ਸ਼ਿਮਲੇ ਦੇ ਵਿੱਚ ਜਦੋਂ ਸੂਰਜ ਛਿਪ ਰਿਹਾ ਸੀ ਤਾਂ ਅਸੀਂ ਉਸ ਟਾਈਮ ਜਿਹੜੀ ਤਸਵੀਰ ਖਿੱਚੀ ਸੀ ਉਹ ਮੇਰੀ ਪਹਿਲੀ ਤਸਵੀਰ ਜਿਹੜੀ ਖਿੱਚੀ ਗਈ ਸੀਗੀ ਮੇਰੇ ਘਰਦਿਆਂ ਨੇ ਮੈਨੂੰ ਬੀ ਏ ਦੇ ਵਿੱਚ ਜਿਹੜਾ ਸੈਮਸੰਗ ਦਾ ਫ਼ੋਨ ਲੈ ਕੇ ਦਿੱਤਾ ਸੀ ਉਸ ਟਾਈਮ ਮੇਰੇ ਕੋਲੇ ਜਿਹੜਾ ਨਵਾਂ ਨਵਾਂ ਫ਼ੋਨ ਆਇਆ ਸੀ ਅਤੇ ਉਹ ਫ਼ੋਨ ਦੀ ਕੈਮਰਾ ਕੁਆਲਿਟੀ ਇੰਨੀ ਵਧੀਆ ਸੀ ਕਿ ਉਹਨੇ ਜਿਹੜਾ ਸੂਰਜ ਛਿਪਣ ਟਾਈਮ ਦੀ ਜੋ ਵਿਊ ਸੀਗਾ ਸੂਰਜ ਬਿਖਰ ਜ ਜਿਹੜੇ ਰੰਗ ਬਿਖਾਰ ਰਿਹਾ ਸੀਗਾ ਉਹ ਚੀਜ਼ ਨੂੰ ਜਿਹੜਾ ਕੈਮਰੇ ਦੇ ਵਿੱਚ ਕੈਦ ਕੀਤਾ ਸੀਗਾ ਤਾਂ ਉਹ ਤਸਵੀਰ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਸਭ ਤੋਂ ਫੇਵਰੇਟ ਤਸਵੀਰ ਜਿਹੜੀ ਸੀਗੀ